ਸਥਾਨਿਕ ਆਰਥਿਕਤਾ ਵਿੱਚ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਬਹੁਤ ਅਹਿਮੀਅਤ ਰੱਖਦੇ ਹਨ ਛੋਟੇ ਅਤੇ ਦਰਮਿਆਨਾ ਆਕਾਰ ਦੇ ਕਾਰੋਬਾਰ ਵਿੱਚ ਨਵੇਂ ਨਵੇਂ ਵਿਚਾਰ ਯੋਜਨਾਵਾਂ ਨੂੰ ਪਸੋਨਿਤ ਕਿਤ ਕਰਦੇ ਹਨ ਛੋਟੇ ਅਤੇ ਦਰਮਿਆਨੇ ਕਾਰੋਬਾਰ ਆਪਣੇ ਆਪ ਨੂੰ ਸਫਲ ਕਰਨ ਲਈ ਉਤਪਾਦਾਂ ਦੀ ਗੁਣਵੱਤਾ ਗੁਣਵੱਤਾ ਅਤੇ ਸੇਵਾਵਾਂ ਦਾ ਬਹੁਤ ਧਿਆਨ ਰੱਖਦੇ ਹਨ ਜਿਸ ਨਾਲ ਕਿਸੇ ਪਿੰਡ ਜਾਂ ਕਸਬੇ ਦੀ ਬਹੁਤ ਤਰੱਕੀ ਹੋ ਸਕਦੀ ਹੈ ਲਘੂ ਉਦਯੋਗਤਾ ਦੀ ਸਫਲਤਾ ਨਾਲ ਉੱਥੋਂ ਦੇ ਲੋਕਾਂ ਦੀ ਸੋਚ 'ਤੇ ਵੀ ਬਹੁਤ ਅਸਰ ਪੈਂਦਾ ਹੈ ਉਹ ਲਘੂ ਉਦਯੋਗਤਾ ਨੂੰ ਸਫਲ ਕਰਨ ਲਈ ਨਵੇਂ ਨਵੇਂ ਤਰੀਕੇ ਸੋਚਦੇ ਹਨ ਨਵੀਆਂ ਟੈਕਨੋਲੋਜੀਆਂ ਨੂੰ ਆਪਣੇ ਅਪਣਾਉਂਦੇ ਹਨ ਜਿਹਨਾਂ ਨਾਲ ਉਹਨਾਂ ਦੀ ਸੋਚ ਅਗਾਂਹ ਵਧੂ ਹੁੰਦੀ ਹੈ ਇਸ ਲਘੂ ਉਦਯੋਗਤਾ ਦੇਸ਼ ਦੀ ਅਗਵਾਹੀ ਕਹੀ ਬਾਹਰਲੇ ਦੇਸ਼ ਵਿਚ ਕਰਦੇ ਹਨ ਜਿਸ ਤਰ੍ਹਾਂ ਪੰਜਾਬ ਅਸਾਮ ਯੂਪੀ ਕਈ ਅਜਿਹੇ ਦੇਸ ਦੇਸ਼ਾਂ ਦੀ ਦਸਤਾਕਾਰੀ ਉਦਯੋਗ ਬਾਹਰਲੇ ਦੇਸ਼ਾਂ ਵਿੱਚ ਬਹੁਤ ਮਸ਼ਹੂਰ ਹਨ ਜਿਸ ਨਾਲ ਦੇਸ਼ ਦੀ ਆਰਥਿਕਤਾ ਅਤੇ ਮਾਨ ਸਨਮਾਨ ਵਿੱਚ ਵਾਧਾ ਹੁੰਦਾ ਹੈ